ਪੰਦਰ੍ਹਾਂ ਮਈ ਉੱਨੀ ਸੌ ਤ੍ਰਿਆਨਵੇਂ ਦੋ ਜੂਨ ਉੱਨੀ ਸੌ ਪਚਾਨਵੇਂ ਸੋਲ੍ਹਾਂ ਜੁਲਾਈ ਉੱਨੀ ਸੌ ਛਿਆਨਵੇਂ ਇੱਕ ਅਗਸਤ ਉੱਨੀ ਸੌ ਚੁਰਾਨਵੇਂ ਪੰਦਰ੍ਹਾਂ ਫਰਬਰੀ ਦੋ ਹਜ਼ਾਰ ਪੰਦਰ੍ਹਾਂ